ਪੰਜਾਬ ਦੇ ਵਿੱਚ ਬਹੁਤ ਸਾਰੇ ਤਰ੍ਹਾਂ ਦੇ ਪਸ਼ੂ ਪਾਲੇ ਜਾਂਦੇ ਹਨ ਕਿਉਂਕਿ ਪੰਜਾਬੀਆਂ ਦਾ ਮੁੱਖ ਕਿੱਤਾ ਖੇਤੀਬਾੜੀ ਨਾਲ ਹੀ ਰਿਲੇਟਡ ਰਿਹਾ ਹੈ ਜੋ ਕਿ ਸ਼ੁਰੂ ਤੋਂ ਹੀ ਪੰਜਾਬ ਦੇ ਵਿੱਚ ਸਭ ਤੋਂ ਪਹਿਲਾਂ ਪੁਰਾਣੇ ਪੰਜਾਬ 'ਚ ਜ਼ਿਆਦਾ ਊਠਾਂ ਦੇ ਨਾਲ ਖੂਹਾਂ ਤੋਂ ਪਾਣੀ ਕੱਢਣ ਵਾਸਤੇ ਊਠਾਂ ਨੂੰ ਉਹਨਾਂ ਨਾਲ ਜੋੜਿਆ ਜਾਂਦਾ ਸੀ ਖੂਹਾਂ ਦੇ ਉੱਤੇ ਜਿੰਨ੍ਹਾਂ ਨਾਲ ਕੇ ਪਾਣੀ ਕੱਢਿਆ ਜਾਂਦਾ ਸੀ ਔਰ ਫਿਰ ਬਲਦ ਵੀ ਖੂਹ ਦੇ ਨਾਲ ਜੋੜੇ ਜਾਂਦੇ ਸਨ ਤਾਂ ਕਿ ਖੂਹਾਂ ਤੋਂ ਪਾਣੀ ਕੱਢਿਆ ਜਾ ਸਕੇ ਅਤੇ ਖੇਤੀ ਲਈ ਵਰਤਿਆ ਜਾ ਸਕੇ ਇਸ ਦੀ ਸ਼ੁਰੂ ਤੋਂ ਹੀ ਪੰਜਾਬ ਵਿੱਚ ਜਾਨਵਰਾਂ ਨੂੰ ਪਾਲਣ ਦਾ ਰਿਵਾਜ਼ ਰਿਹਾ ਹੈ ਤਾਂ ਕਿ ਘਰਾਂ ਦੇ ਵਿੱਚ ਆਮ ਵਰਤੋਂ ਵਾਸਤੇ ਬੈਲਗੱਡੀ ਲਈ ਘੋੜਿਆਂ ਦੇ ਲਈ ਘੋੜ ਸਵਾਰੀ ਲਈ ਜਾਂ ਟਾਂਗਿਆਂ ਲਈ ਸ ਆਉਣ ਜਾਣ ਦੇ ਸਾਧਨਾਂ ਵਾਸਤੇ ਘੋੜਿਆਂ ਦੀਆਂ ਵਰਤੋਂ ਕੀਤੀ ਜਾਂਦੀ ਸੀ ਵਿਆਹ ਸ਼ਾਦੀਆਂ 'ਤੇ ਵੀ ਪੰਜਾਬ ਵਿੱਚ ਘੋੜੀ ਚੜਾਉਣ ਦਾ ਰਿਵਾਜ਼ ਬਹੁਤ ਦੇਖਣ ਨੂੰ ਮਿਲਦਾ ਹੈ ਜੋ ਕਿ ਅੱਜ ਵੀ ਇਕ ਰਿਵਾਜ਼ ਵਿਚ ਬਦਲ ਚੁੱਕਿਆ ਹੈ ਇਸ ਤਰ੍ਹਾਂ ਹੀ ਗਊਆਂ ਭੇਡਾਂ ਬੱਕਰੀਆਂ ਮੁਰਗੀਆਂ ਘਰਾਂ ਦੇ ਵਿੱਚ ਆਮ ਹੀ ਰੱਖੀਆਂ ਜਾਂਦੀਆਂ ਹਨ ਕੁੱਕੜਾਂ ਨੂੰ ਪਹਿਲਾਂ ਪੁਰਾਣੇ ਪੰਜਾਬ ਵਿੱਚ ਖਿਡਾਉਣ ਦਾ ਲੜਾਉਣ ਦਾ ਰਿਵਾਜ਼ ਵੀ ਸੀ ਇੱਕ ਗੇਮ ਦੇ ਤੌਰ 'ਤੇ ਖੇਡਿਆ ਜਾਂਦਾ ਸੀ ਮੱਝਾਂ ਨੂੰ ਦੁੱਧ ਵਾਸਤੇ ਗਊਆਂ ਨੂੰ ਇਹਦੇ ਵਾਸਤੇ ਵਰਤਿਆ ਜਾਂਦਾ ਸੀ ਆਮ ਹੀ ਘਰਾਂ ਵਿੱਚ ਮੱਝਾਂ ਗਾਵਾਂ ਵਰਤੀਆਂ ਜਾਂਦੀਆਂ ਸੀ ਜਿਵੇਂ ਇਹਨਾਂ ਦੇ ਵਿੱਚ ਮੁੱਖ ਸਾਹੀਵਾਲ ਨੀਲੀ ਆਦਿ ਕਿਸਮਾਂ ਦੀ ਮੱਝਾਂ ਰੱਖੀਆਂ ਜਾਂਦੀਆਂ ਸਨ ਗਾਵਾਂ ਰੱਖੀਆਂ ਜਾਂਦੀਆਂ ਸਨ ਬੱਕਰੀਆਂ ਵੀ ਰੱਖਣ ਦਾ ਘਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਰੱਖਣ ਦਾ ਰਿਵਾਜ਼ ਸੀ ਦੁੱਧ ਵੀ ਇਹਨਾਂ ਤੋਂ ਲਿਆ ਜਾਂਦਾ ਬੱਕਰੇ ਵੀ ਪਾਲੇ ਜਾਂਦੇ ਸਨ ਜੋ ਕਿ ਮੀਟ ਦੇ ਔਰ ਕੰਮ ਆਉਂਦੇ ਸਨ ਕੁੱਕੜ ਵੀ ਲੋਕ ਪਲਦੇ ਸਨ ਜੋ ਕਿ ਮੀਟ ਮੁਰਗੇ ਬਣਾਉਣ ਦੇ ਕੰਮ ਆਉਂਦੇ ਸਨ ਇਸ ਤਰ੍ਹਾਂ ਹੀ ਪਸ਼ੂਆਂ ਦੇ ਮੇਲੇ ਵੀ ਬਹੁਤ ਲੱਗਦੇ ਹਨ ਜਿਨ੍ਹਾਂ ਦੇ ਵਿੱਚ ਪਸ਼ੂਆਂ ਦੀ ਖਰੀਦੋ ਫਰੋਖਤ ਵੀ ਕੀਤੀ ਜਾਂਦੀ ਹੈ ਔਰ ਪਸ਼ੂ ਸਾਡੇ ਜੀਵਨ ਦਾ ਬਹੁਤ ਹੀ ਨ ਨੇੜਲਾ ਅੰਗ ਹਨ ਜਿਨ੍ਹਾਂ ਬਿਨਾਂ ਪੰਜਾਬ ਦੀ ਜਨਜੀਵਨ ਸੰਭਵ ਨਹੀਂ ਹੈ